ਸਤਿ ਸ਼੍ਰੀ ਅਕਾਲ ਜੀ ਮੈਨੂੰ ਮੇਰੇ ਜੱਦੀ ਸ਼ਹਿਰ ਵਿੱਚ ਸਭ ਤੋਂ ਮਨ ਵਿੱਚ ਪਸੰਦ ਇਹ ਗੱਲ ਹੈ ਕਿ ਮੇਰੇ ਜੱਦੀ ਸ਼ਹਿਰ ਵਿੱਚ ਧਾਰਮਿਕ ਲੋਕ ਬਹੁਤ ਜ਼ਿਆਦਾ ਜ਼ਿਆਦਾ ਨੂੰ ਇੱਥੇ ਹਰ ਇੱਕ ਗੁਰੂ ਨੂੰ ਮੰਨਿਆ ਜਾਂਦਾ ਹੈ ਕੋਈ ਵੀ ਧਰਮ ਵਿਵਾਦ ਨਹੀਂ ਲੋਕ ਵਿੱਚ ਭਾਵੇਂ ਮੁਸਲਿਮ ਹੋਵੇ ਭਾਵੇਂ ਸਿੱਖ ਹੋਏ ਅਤੇ ਭਾਵੇਂ ਈਸਾਈ ਹੋਏ ਸਭ ਇੱਕ ਮਿਲ ਰਲ ਕੇ ਰਹਿੰਦੇ ਹਨ ਮੇਰੇ ਸ਼ਹਿਰ ਵਿੱਚ ਕਾਫੀ ਗੁਰਦੁਆਰੇ ਸਾਹਿਬ ਵੀ ਹਨ ਅਤੇ ਜਿੱਥੇ ਅਟੁੱਟ ਲੰਗਰ ਚਲਦਾ ਹੈ ਅਤੇ ਬਿਨਾਂ ਕਿਸੇ ਚੀਜ਼ ਬਿਨਾਂ ਕਿਸੇ ਪੈਸੇ ਛਕਾਇਆ ਜਾਂਦਾ ਹੈ ਸਭ ਲੋਕ ਇੱਕੇ ਪੰਗਤ ਵਿੱਚ ਬਹਿ ਕੇ ਲੰਗਰ ਛੱਕਦੇ ਹਨ ਅਮੀਰ ਗਰੀਬ ਦਾ ਕੋਈ ਭਾਵ ਭੇਦ ਨਹੀਂ ਕੀਤਾ ਜਾਂਦਾ ਹਰ ਇੱਕ ਇਨਸਾਨ ਨੂੰ ਇੱਕੋ ਜਿਹੀ ਚੀਜ਼ ਦਿੱਤੀ ਜਾਂਦੀ ਹੈ ਜਿੱਥੇ ਹੁਣ ਮੈਂ ਆਪਣੇ ਸਭ ਪ੍ਰਸਿੱਧ ਗੁਰਦੁਆਰੇ ਦੀ ਗੱਲ ਕਰਾਂ ਤਾਂ ਹਰਿਮੰਦਰ ਸਾਹਿਬ ਜਿਸ ਨੂੰ ਸਵਰਨ ਮੰਦਰ ਮੰਦਰ ਕਿਹਾ ਜਾਂਦਾ ਹੈ ਇਸ ਉੱਪਰ ਕਹਿੰਦੇ ਹਨ ਕਿ ਅਵਸਥਾ ਵੀ ਅਤੇ ਇੱਥੇ ਅਟੁੱਟ ਚੌਵੀ ਘੰਟੇ ਲੰਗਰ ਚਲਦਾ ਹੈ ਇਸ ਦੇ ਚਾਰ ਦਰਵਾਜ਼ੇ ਹਨ ਜੋ ਕਿ ਚਾਰੇ ਪਾਸੇ ਧਰਮਾਂ ਵਾਸਤੇ ਖੁੱਲ੍ਹੇ ਰਹਿੰਦੇ ਹਨ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਨ ਕੀਤਾ ਜਾਂਦਾ ਇੱਥੇ ਨੇ ਮਨ ਮ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਹ ਬਹੁਤ ਸਾਫ ਸੁਥਰਾ ਹੈ ਇੱਥੇ ਹਰਿਆਲੀ ਵੀ ਬਹੁਤ ਹੈ ਇਸਦੇ ਵਾਤਾਵਰਨ ਨਾਲ ਵਾਤਾਵਰਨ ਨਾਲ ਵੀ ਬੜਾ ਪਿਆਰ ਕਰਦੇ ਹਨ ਮੈਨੂੰ ਬੜਾ ਮਾਣ ਹੈ ਕਿ ਮੈਂ ਆਪਣੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਹਾਂ ਕਿਉਂਕਿ ਅੰਮ੍ਰਿਤਸਰ ਗੁਰੂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਉਹ ਇਸ ਉੱਤੇ ਇੱਕ ਕੋਈ ਸੰਕਟ ਨਹੀਂ ਆਉਂਦਾ ਕਿਉਂਕਿ ਕਹਿੰਦੇ ਹਨ ਕਿ ਜਿੱਥੇ ਗੁਰੂ ਚੌਵੀ ਘੰਟੇ ਅੰਗ ਸੰਗ ਸਹਾਈ ਰਹਿੰਦੇ ਹਨ ਰਹਿੰਦੇ ਹਨ ਧੰਨਵਾਦ ਜੀ